ਮੇਰਾ ਨਾਮ ਵਿਸ਼ਾਲ ਕੁਮਾਰ ਹੈ ਅਤੇ ਮੇਰਾ ਪਿੰਡ ਰੈਲ ਮਾਜਰਾ ਹੈ ਅਤੇ ਮੈਂ ਬਲਾਚੋਰ ਟੈਕਸੀ ਡਰੈਵਰ ਟੈਕਸੀ ਬੁੱਕ ਕੀਤੀ ਸੀ ਬਲਾਚੋਰ ਅਤੇ ਉਹ ਟੈਕਸੀ ਡਰੈਵਰ ਹਾਲੇ ਤੱਕ ਨਹੀਂ ਪਹੁੰਚਿਆ ਮੇਰੇ ਕੋਲ ਮੈਂ ਤੁਹਾਡੇ ਭਾਈ ਟੈਕਸੀ ਦੇ ਮਾਲਕ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਜਲਦੀ ਹੀ ਮਨਾਲੀ ਜਾਣਾ ਹੈ ਅਤੇ ਧੁੰਦਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ ਇਸ ਕਰਕੇ ਮੈਂ ਜਲਦੀ ਤੋਂ ਜਲਦੀ ਪਹੁੰਚਣਾ ਹੈ ਅਤੇ ਪਲੀਸ ਏ ਟਰੈ ਆਪਣੇ ਡਰੈਵਰ ਨੂੰ ਜਲਦੀ ਹੀ ਭੇਜ ਦਿਓ ਅਤੇ ਮੇਰਾ ਸਫ਼ਰ ਜਲਦੀ ਹੀ ਮੁੱਕ ਸਕੇ ਅਤੇ ਮੈਂ ਇਸ ਕਰਕੇ ਮੇਰਾ ਜਾਣਾ ਬਹੁਤ ਹੀ ਜ਼ਰੂਰੀ ਹੈ ਅਤੇ ਮੈਂ ਜਾ ਕੇ ਵੀ ਬਹੁਤ ਹੀ ਉੱਥੇ ਜ਼ਰੂਰੀ ਕੰਮ ਕਰਨਾ ਹੈ ਅਤੇ ਆਪਣਾ ਟੈਕਸੀ ਡਰੈਵਰ ਨੂੰ ਬਹੁਤ ਹੀ ਜਲਦੀ ਭੇਜ ਦਿਓ